ਵੱਖ ਵੱਖ ਧਰਮਾਂ ਦੇ ਵਿੱਚ ਪਰਮਾਤਮਾ ਅੱਗੇ ਕੀਤੀ ਗਈ ਅਰਜ਼ੋਈ ਨੂੰ ਵੱਖ ਵੱਖ ਨਾਮ ਦਿੱਤੇ ਗਏ ਨੇ ਦਿੱਤੇ ਜਾਂਦੇ ਨੇ ਸਿੱਖ ਧਰਮ ਦੇ ਅੰਦਰ ਇਸ ਅਰਜੋਈ ਨੂੰ ਅਰਦਾਸ ਕਿਹਾ ਜਾਂਦਾ ਕਿ ਅਰਦਾਸ ਕਰਨਾ ਇਹਦੇ ਬਾਬਤ ਝੂਠ ਤਾਂ ਕੁਝ ਵੀ ਨਹੀਂ ਆ ਜੇ ਸੱਚੇ ਮਨ ਤੋਂ ਸੱਚੇ ਹਿਰਦੇ ਤੋਂ ਅਕਾਲ ਪੁਰਖ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਹੋਇਆਂ ਪਰਮਾਤਮਾ ਨੂੰ ਮਹਿਸੂਸ ਕਰਦੇ ਹਾਂ ਉਹਦੇ ਚਰਨਾਂ ਦੇ ਵਿੱਚ ਜਦੋਂ ਕੋਈ ਅਰਦਾਸ ਕਰਦਾ ਤਾਂ ਉਹ ਜ਼ਰੂਰ ਕਬੂਲ ਹੁੰਦੀ ਹੈ ਪਰ ਇੰਨਾ ਜਰੂਰ ਹੈ ਕਿ ਅਰਦਾਸ ਦਿਮਾਗ ਦੇ ਨਾਲ ਚਤੁਰਾਈ ਦੇ ਨਾਲ ਸਿਆਣਪਾਂ ਦੇ ਨਾਲ ਨਾ ਕੀਤੀ ਜਾਵੇ ਅਰਦਾਸ ਹਿਰਦੇ ਤੋਂ ਨਿਕਲੇ ਅਤੇ ਜ਼ਰੂਰੀ ਵੀ ਨਹੀਂ ਹੈ ਕਿ ਅਰਦਾਸ ਕਰਨ ਸਮੇਂ ਤੁਹਾਡੀ ਸ਼ਬਦਾਵਲੀ ਤੁਹਾਡੇ ਸ਼ਬਦ ਤੁਹਾਡੇ ਜੋ ਅਲਫਾਜ਼ ਨੇ ਉਹ ਮਾਇਨੇ ਰੱਖਦੇ ਨੇ ਨਹੀਂ ਤੁਹਾਡੀ ਭਾਵਨਾ ਹੋਣੀ ਚਾਹੀਦੀ ਹੈ ਤੁਸੀਂ ਭਾਵਨਾ ਦੇ ਨਾਲ ਆਪਣੇ ਮਨ ਦੀ ਭਾਵਨਾ ਨੂੰ ਵਿਅਕਤ ਕਰੋ ਉਹ ਹੰਝੂਆਂ ਰਾਹੀਂ ਵੀ ਹੋ ਸਕਦੀ ਹੈ ਹੈ ਨਾ ਪਰ ਜ਼ਰੂਰੀ ਨਹੀਂ ਹੈ ਕਿ ਉਹ ਸ਼ਬਦਾਂ ਰਾਹੀਂ ਹੀ ਕਿਉਂਕਿ ਸ਼ਬਦ ਉੱਥੇ ਕੰਮ ਕਰਦੇ ਨੇ ਜਿੱਥੇ ਬੰਦਾ ਸ਼ਬਦਾਂ ਦਾ ਮੁਥਾਜ ਆ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹ ਕਦੇ ਵੀ ਸ਼ਬਦਾਂ ਦਾ ਮੁਥਾਜ ਨਹੀਂ ਆ ਉਹ ਤਾਂ ਘਟ ਘਟ ਕੇ ਅੰਤਰ ਕੀ ਜਾਨਤ ਉਹ ਅੰਦਰ ਦੀਆਂ ਜਾਨਣ ਵਾਲਾ ਉੱਥੇ ਤੁਸੀਂ ਨਹੀਂ ਵੀ ਕੁਝ ਬੋਲਦੇ ਤਾਂ ਵੀ ਉਹ ਤੁਹਾਡੇ ਅੰਦਰ ਦੀ ਜਾਣਦਾ ਇਸ ਕਰਕੇ ਪ੍ਰਾਰਥਨਾਵਾਂ ਜ਼ਰੂਰ ਕੰਮ ਕਰਦੀਆਂ ਨੇ ਅਰਦਾਸਾਂ ਕੰਮ ਕਰਦੀਆਂ ਨੇ ਜੇ ਸੱਚੇ ਮਨੋ ਧਨੋ ਕੀਤੀਆਂ ਜਾਣ ਜੇ ਉਹ ਛਲ ਕਰਕੇ ਦਿਖਾਵੇ ਕਰਕੇ ਨੇ ਫਿਰ ਉਹ ਬੇਲੋੜੀਆਂ ਨੇ ਫਿਰ ਉਹ ਸਹੀ ਨਹੀਂ ਨੇ